ਜੀ ਹਾਂ ਸਾਡੇ ਖੇਤਰ ਦੇ ਕਈ ਨੇੜਲੇ ਇਲਾਕਿਆਂ ਦੇ ਉੱਤੇ ਬਹੁਤ ਹੀ ਸਾਰੇ ਇਤਿਹਾਸਿਕ ਮਹੱਤਵ ਵਾਲੇ ਕਿਲ੍ਹੇ ਅਤੇ ਮੰਦਰ ਸਮਾਰਕ ਹਨ ਅਤੇ ਅਸੀਂ ਆਮ ਤੌਰ 'ਤੇ ਉੱਥੇ ਜਾਂਦੇ ਰਹਿੰਦੇ ਹਾਂ ਜਿਵੇਂ ਕਿ ਸਾਡੇ ਖੇਤਰ ਦੇ ਨੇੜੇ ਇੱਕ ਨਾਭਾ ਸ਼ਹਿਰ ਹੈ ਜਿੱਥੋਂ ਦਾ ਮਹਿਲ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਇਸ ਤੋਂ ਅਸੀਂ ਬਹੁਤ ਸਾਡੇ ਖੇਤਰ ਦੇ ਨੇੜੇ ਤੇੜੇ ਬਹੁਤ ਸਾਰੇ ਗੁਰਦੁਆਰੇ ਹਨ ਜਿਹਨਾਂ ਦਾ ਬਹੁਤ ਹੀ ਇਤਿਹਾਸਿਕ ਪਿਛੋਕੜ ਅਤੇ ਜੋ ਲੋਕਾਂ ਵੱਲੋਂ ਬਹੁਤ ਹੀ ਸ਼ਰਧਾ ਪੂਰਵਕ ਮੰਨਿਆਂ ਜਾਂਦਾ ਆ ਅਤੇ ਲੋਕ ਉੱਥੋਂ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਵੀ ਹਨ ਅਤੇ ਬਹੁਤ ਹੀ ਸਤਿਕਾਰ ਵੀ ਕਰਦੇ ਹਨ ਇਸ ਤੋਂ ਸਿਵਾ ਕਈ ਮੰਦਰ ਵੀ ਹਨ ਜਿਨ੍ਹਾਂ ਦਾ ਬਹੁਤ ਹੀ ਜ਼ਿਆਦਾ ਇਤਿਹਾਸ ਪੂਰਵਕ ਇਤਿਹਾਸ ਪਿਛੋਕੜ ਹੈ ਜੋ ਲੋਕਾਂ ਵੱਲੋਂ ਮੰਨਿਆਂ ਜਾਂਦਾ ਅਤੇ ਉੱਥੇ ਦਾ ਸਤਿਕਾਰ ਕੀਤਾ ਜਾਂਦਾ ਹੈ ਅਤੇ ਜੋ ਵੀ ਉੱਥੇ ਮੰਗ ਪੂਰਦੀਆਂ ਕਰਦੇ ਹਨ ਲੋਕਾਂ ਦੀਆਂ ਪੂਰੀਆਂ ਹੋ ਜਾਂਦੀਆਂ ਹਨ ਫੋਰ ਇਗਜਾਮਪਲ ਦੇ ਤੌਰ 'ਤੇ ਸਾਡੇ ਪਿੰਡ ਸਾਡੇ ਇਲਾਕੇ ਦੇ ਨੇੜੇ ਇੱਕ ਮਨਪੁਰ ਪਿੰਡ ਹੈ ਜਿੱਥੋਂ ਦੇ ਮੰਦਰ ਵਿੱਚ ਬਹੁਤ ਹੀ ਜ਼ਿਆਦਾ ਮਾਨਤਾ ਹੈ ਕਿ ਉੱਥੇ ਕੋਈ ਵੀ ਪ੍ਰਕਾਰ ਦੇ ਅਗਰ ਚਿਕਨਪੋਕਸ ਜਾਂ ਮਾਤਾ ਹੁੰਦੀ ਹੈ ਤਾਂ ਉੱਥੋਂ ਹਥੋਲਾ ਪਵਾ ਕੇ ਸਹੀ ਹੋ ਜਾਂਦਾ ਅਤੇ ਲੋਕ ਇਹ ਮੰਨਦੇ ਵੀ ਹਨ ਅਤੇ ਇੱਦਾਂ ਹੁੰਦਾ ਵੀ ਹੈ ਸੋ ਯੈੱਸ